ਜਦੋਂ ਮੈਂ ਕੋਲਜ ਵਿੱਚ ਸੀ ਉਦੋਂ ਮੈਂ ਰੋਪੜ ਦਾ ਨਕਸ਼ਾ ਬਣਾਇਆ ਸੀ ਜਿਸ ਵਿੱਚ ਪੁਲਿਸ ਸਟੇਸ਼ਨ ਕਿਸ ਜਗ੍ਹਾ 'ਤੇ ਹੋਵੇਗਾ ਰੋਡ ਮੈਪ ਕਿਸ ਤਰ੍ਹਾਂ ਦਾ ਹੋਵੇਗਾ ਦਰਿਆ 'ਤੇ ਬ੍ਰਿਜ ਕਿਸ ਤਰ੍ਹਾਂ ਦਾ ਹੋਵੇਗਾ ਹੋਸਪੀਟਲ ਮਾਰਕੀਟ ਕਿਸ ਤਰ੍ਹਾਂ ਦੀ ਹੋਵੇਗੀ ਜਿਸ ਨੂੰ ਕਿ ਅੱਜ ਦੇ ਜਿਹੜੇ ਬੱਚੇ ਨੇ ਉਹ ਓਨਾਂ ਚੰਗਾ ਨਹੀਂ ਕਰ ਸਕਦੇ ਮੈਨੂੰ ਇਸ ਨਕਸ਼ਾ ਬਣਾਉਣ ਚ ਬਹੁਤ ਹੀ ਮਾਣ ਪ੍ਰਾਪਤ ਹੋਇਆ